ਜੇ ਤੁਸੀਂ ਪਹਿਲੀ ਵਾਰ ਫਸਲ ਬੀਮਾ ਖਰੀਦਣ ਬਾਰੇ ਮੈਂ ਸੋਚ ਰਿਹਾ ਹਾਂ ਤਾਂ ਸਥਾਨਕ ਖੇਤੀਬਾੜੀ ਦਫਤਰ ਦੁਆਰਾ ਆਯੋਜਿਤ ਵਰਸ਼ਾ ਵੈਬਿਨਰ ਵਿੱਚ ਹਿੱਸਾ ਲੈਣਾ ਬਹੁਤ ਲਾਭਦਾਇਕ ਹੈ ਇਹ ਇਹਨਾਂ ਗੱਲਾਂ ਦੀ ਪ੍ਰਾਪਤੀ ਅਨੁਸਾਰ ਇਹਨਾਂ ਗੱਲਾਂ ਦੀ ਪ੍ਰਾਪਤੀ ਪਾਲਸੀ ਦੀ ਜਾਣਕਾਰੀ ਪਾਲਸੀ ਦੀਆਂ ਕਿਸਮਾਂ ਜਿਵੇਂ ਕਿ ਸਮੁੱਚੀ ਕਵਰੇਜ ਵਿਸ਼ੇਸ਼ ਕਵਰੇਜ ਅਤੇ ਖਤਰੇ ਦੀ ਸਮਝ ਲਈ ਸਪੀਕਰ ਤੋਂ ਸਪਸ਼ਟਤਾ ਪ੍ਰਾਪਤ ਕਰੋ ਪ੍ਰੀਮੀਅਮ ਅਤੇ ਵੇਰਵਿਆਂ ਬੀ ਪ੍ਰੀਮੀਅਮ ਦੀ ਲਾਗਤ ਭੁਗਤਾਨ ਦੀ ਵਿਧੀ ਅਤੇ ਮਿਆਦ ਬਾਰੇ ਪੁੱਛਣਾ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਲਈ ਵਿੱਤੀ ਤੌਰ 'ਤੇ ਕਿਵੇਂ ਪ੍ਰਭਾਵਿਤ ਕਰੇਗਾ ਕਵਰੇਜ ਵਿਕਲਪ ਕਿਹੜੇ ਖਤਰੇ ਜਿਵੇਂ ਕਿ ਤੁਫਾਨ ਬਾਰਿਸ਼ ਦੌਰ ਨੂੰ ਕਬਰ ਕੀਤਾ ਗਿਆ ਜਾਂਦਾ ਕੀਤਾ ਗਿਆ ਅਤੇ ਕਿਹੜੇ ਨਹੀਂ ਇਸ ਬਾਰੇ ਗੱਲਬਾਤ ਕਰਨਾ ਚਾਹੁੰਦਾ ਹਾਂ ਦਾਣੇ ਦੀ ਪ੍ਰਕਿਰਿਆ ਕਿਸੇ ਵੀ ਨੁਕਸਾਨ ਦੇ ਮਾਮਲੇ 'ਚ ਦਾਅਵੇ ਦਾਇਰ ਕਰਨ ਦੀ ਵਿਧੀ ਅਤੇ ਮਿਆਦ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਸਧਾਰਨ ਅਤੇ ਕੇਸ ਸਟਡੀ ਅਨੁਭਵ ਵਾਲੇ ਕਿਸਾਨਾਂ ਦੀਆਂ ਉਦਾਹਰਨਾਂ ਸੁਣੋ ਜਿਹਨਾਂ ਨੇ ਪਿਛਲੇ ਸਾਲਾਂ ਵਿੱਚ ਫਸਲ ਬੀਮਾ ਲਾਭ ਲਿਆ ਮੈਂ ਇੱਕ ਕਿਸਾਨ ਹਾਂ ਮੈਂ ਫਸਲ ਬੀਜਦਾ ਹਾਂ ਮੈਂ ਆਪਣੀ ਫਸਲ ਬਹੁਤ ਹੀ ਇਮਾਨਦਾਰੀ ਨਾਲ ਬੀਜਦਾ ਹਾਂ ਮੇਰੀ ਫਸਲ ਵਿੱਚ ਗੜ੍ਹੇਮਾਰੀ ਹੋ ਜਾਂਦੀ ਹੈ ਕਈ ਪਸ਼ੂ ਗੜ੍ਹੇ ਪ ਕਈ ਪਸ਼ੂ ਖਰਾਬ ਕਰ ਦਿੰਦੇ ਹਨ ਇਸ ਲਈ ਮੈਂ ਇੱਕ ਫਸਲ ਬੀਮਾ ਬਣਾਉਣਾ ਚਾਹੁੰਦਾ ਹੈ ਇਸ ਕਰਕੇ ਮੇਰੀ ਇੱਕ ਬੇਨਤੀ ਹੈ ਮੇਰਾ ਫਸਲ ਬੀਮਾ ਜਲਦ ਤੋਂ ਜਲਦ ਬਣਨਾ ਚਾਹੀਦਾ ਹੈ ਅਨੁਭਵ ਵਾਲੇ ਕਿਸਾਨਾਂ ਦੀਆਂ ਉਦਾਹਰਨਾਂ ਸੁਣੋ ਜਿਹਨਾਂ ਨੇ ਪਿਛਲੇ ਸਾਲਾਂ ਵਿੱਚ ਬੀਮੇ ਦਾ ਲਾਭ ਲਿਆ ਹੈ ਇਸ ਲਈ ਮੈਨੂੰ ਫਸਲ ਬੀਮਾ ਲੈਣਾ ਚਾਹੀਦਾ ਹੈ